ਭਾਰਤ ਦੇ ਰਾਜ ਪੰਜਾਬ ਦੇ ਵਿੱਚ ਲੋਕ ਬਹੁਤ ਉਤਸ਼ਾਹ ਨਾਲ ਧਾਰਮਿਕ ਛੁੱਟੀਆਂ ਅਤੇ ਰੀਤੀ ਰਿਵਾਈਆਂ ਮਨਾਉਂਦੇ ਹਨ ਜਿਵੇਂ ਦੀਵਾਲੀ ਦੁਸਹਿਰਾ ਗੁਰਪੂਰਬ ਦੀਵਾਲੀ ਸ਼੍ਰੀ ਰਾਮ ਚੰਦਰ ਜੀ ਦੇ ਬਨਵਾਸ ਕੱਟਣ ਤੋਂ ਬਾਅਦ ਰਾਵਣ ਨੂੰ ਮਾਰ ਕੇ ਅਯੋਧਿਆ ਵਾਪਸ ਆਏ ਸੀ ਅਤੇ ਗੁਰਪੁਰਬ ਗੁਰੂ ਨਾਨਕ ਦੇਵ ਜੀ ਦਾ ਬਰਥਡੇ ਯਾਨੀ ਕਿ ਗੁਰਪੂਰਬ ਅਤੇ ਦੁਸਹਿਰਾ ਰਾਵਣ ਨੂੰ ਮਾਰ ਕੇ ਸ਼੍ਰੀ ਰਾਮ ਚੰਦਰ ਜੀ ਨੇ ਇੱਕ ਸਮਾਜਿਕ ਕੁਰੀਤੀ ਨੂੰ ਸਮਾਜਿਕ ਜਿਹੜੇ ਬੰਦੇ ਦੇ ਹੰਕਾਰ ਨੂੰ ਮਾਰ ਕੇ ਉਸ 'ਤੇ ਜਿੱਤ ਪ੍ਰਾਪਤ ਕੀਤੀ ਸੀ ਉਸ ਇਹ ਧਰਮਾਂ ਇਹ ਧਾਰਮਿਕ ਜਿਹੜੇ ਤਿਉਹਾਰ ਨੇ ਇਹ ਆਪਣੀ ਸ਼ਰਧਾ ਦੇ ਨਾਲ ਲਾਈਟਿੰਗ ਕਰਕੇ ਦੀਵੇ ਜਗਾ ਕੇ ਅਤੇ ਪਟਾਕੇ ਚਲਾ ਕੇ ਇਹ ਜਿਹੜੇ ਲੋਕ ਨੇ ਆਪਣੇ ਤਿਉਹਾਰ ਨੇ ਉਹ ਮਨਾਉਂਦੇ ਹਨ